ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਟੈਕਨੋਲਜੀ ਨੇ ਫੋਟੋਗ੍ਰਾਫੀ ਦੇ ਖੇਤਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਪਹਿਲਾਂ ਦੇ ਜ਼ਮਾਨੇ ਵਿੱਚ ਅੱਜ ਤੋਂ ਪੰਜ ਤੋਂ ਦਸ ਸਾਲ ਪਹਿਲਾਂ ਜਦੋਂ ਇੰਨੇ ਲੋਕਾਂ ਕੋਲ ਮੋਬਾਈਲ ਨਹੀਂ ਸੀਗੇ ਤਾਂ ਲੋਕ ਆਪਣੇ ਘਰ ਵਿੱਚ ਹੋਣ ਵਾਲੇ ਪਾਠ ਵਿਆਹ ਜਨਮਦਿਨ ਉੱਤੇ ਕੈਮਰਾਮੈਨ ਨੂੰ ਬੁਲਾਉਂਦੇ ਸਨ ਜੋ ਕਿ ਸਾਡੇ ਘਰ ਦੀਆਂ ਸਾਰਿਆਂ ਜੀਆਂ ਦੀ ਫੋਟੋ ਖਿੱਚ ਕੇ ਲੈ ਜਾਂਦਾ ਸੀ ਅਤੇ ਥੋੜ੍ਹੇ ਦਿਨ ਬਾਅਦ ਸਾਨੂੰ ਤਿਆਰ ਕਰਕੇ ਦੇ ਜਾਂਦਾ ਸੀ ਪਰ ਹੁਣ ਸਮਾਂ ਬਦਲ ਰਿਹਾ ਹੈ ਹੁਣ ਸਾਰੇ ਘਰਾਂ ਵਿੱਚ ਸਭ ਕੋਲ ਮੋਬਾਇਲ ਫੋਨ ਦੀ ਵਰਤੋਂ ਜ਼ਿਆਦਾ ਹੋ ਗਈ ਹੈ ਤੁਹਾਨੂੰ ਕਿ ਛੋਟੇ ਫੰਕਸ਼ਨਾਂ ਉੱਤੇ ਜਿਵੇਂ ਜਨਮਦਿਨ ਪਾਠ ਉਸ ਵਿੱਚ ਕੈਮਰਾਮੈਨ ਨੂੰ ਨਹੀਂ ਬੁਲਾਇਆ ਜਾਂਦਾ ਕਿਉਂਕਿ ਉਹ ਆਪਣੇ ਫੋਨ ਦੇ ਨਾਲ ਹੀ ਵੀਡੀਓ ਜਾਂ ਫੋਟੇ ਖਿੱਚ ਲੈਂਦੇ ਹਨ ਅਤੇ ਨਾਲ ਹੀ ਉਹਨਾਂ ਨੂੰ ਆਪਣੀ ਯਾਦਾਂ ਬਣਾ ਕੇ ਆਪਣੇ ਫੋਨ ਵਿੱਚ ਰੱਖ ਲੈਂਦੇ ਹਨ ਜਿਸ ਕਰਕੇ ਉਹਨਾਂ ਨੂੰ ਕਾਗਜ਼ ਵਾਲੀ ਫੋਟੋ ਵੀ ਸਾਂਭਣ ਦੀ ਲੋੜ ਨਹੀਂ ਹੈ ਅਤੇ ਕਾਗਜ਼ ਵਾਲੀ ਫੋਟੋ ਵੀ ਇੱਕ ਟਾਈਮ ਤੋਂ ਬਾਅਦ ਖਰਾਬ ਹੋ ਜਾਂਦੀ ਹੈ ਪਰ ਮੋਬਾਈਲ ਵਿੱਚ ਫੋਟੋ ਇੱਕ ਚੰਗੀ ਤਰ੍ਹਾਂ ਨਾਲ ਸੇਵ ਰਹਿੰਦੀ ਹੈ ਜਿਸ ਕਰਕੇ ਸਾਨੂੰ ਵੀ ਬਹੁਤ ਸਾਰੀ ਯਾਦਾਂ ਇਕੱਠੀ ਕਰ ਲੈਂਦੇ ਹਨ ਅਤੇ ਅੱਜ ਕੱਲ੍ਹ ਮੋਬਾਈਲ ਆਨ ਕਰਕੇ ਲੋਕਾਂ ਦਾ ਇੱਕ ਦੂਜੇ ਨਾਲ ਸਮਾਂ ਵੀ ਬਹੁਤ ਅੱਛਾ ਲੰਘ ਰਿਹਾ ਹੈ ਧੰਨਵਾਦ